ਵੈਸੇ ਤਾਂ ਮੈਨੂੰ ਕਵਿਤਾ ਵਗੈਰਾ ਲਿਖਣ ਦੀ ਕੋਈ ਜਾਂਚ ਨਹੀਂ ਹੈਗੀ ਪਰ ਫਿਰ ਵੀ ਕਈ ਵਾਰੀ ਆਪਣੇ ਮਨ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਮੇਰੀ ਇੱਕ ਬੇਟੀ ਹੈ ਜੋ ਛੋਟੀ ਹੈ ਉਸ ਨੂੰ ਬੜਾ ਸ਼ੌਕ ਹੈ ਉਸਦੀ ਡਰਾਇੰਗ ਵੀ ਬਹੁਤ ਵਧੀਆ ਹੈ ਅਤੇ ਉਹ ਲਿਖਦੀ ਵੀ ਬਹੁਤ ਵਧੀਆ ਹੈ ਉਹ ਮਦਰਸ ਡੇਅ 'ਤੇ ਹੋਰ ਕਈ ਮ ਜਿਵੇਂ ਮੇਰੇ ਜਨਮਦਿਨ 'ਤੇ ਉਹਨੇ ਕਾਰਡ ਬਣਾਉਣਾ ਅਤੇ ਉਹ 'ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਮੇਰੇ ਬਾਰੇ ਲਿਖਣੀਆਂ ਜਾਂ ਕਵਿਤਾ ਰੂਪ ਵਿੱਚ ਉਹ ਬਹੁਤ ਕੁਛ ਵਧੀਆ ਵਧੀਆ ਲਿਖਦੀ ਹੈ ਅਤੇ ਉਸ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਹੋਇਆ ਕਿ ਮੈਂ ਇਸ ਦੇ ਬਾਰੇ ਕੁਛ ਲਿਖਾਂ ਜਿਸ ਦੇ ਕਰਕੇ ਇਹਨੂੰ ਵੀ ਵਧੀਆ ਲੱਗੇਗਾ ਤਾਂ ਮੈਂ ਬੜੀ ਮਤਲਬ ਸੋਚਣ ਤੋਂ ਕਾਫੀ ਚੀਜ਼ਾਂ ਇੱਧਰੋਂ ਕਿਤਾਬਾਂ ਕਤੂਬਾਂ ਪੜ੍ਹ ਕੇ ਬੜੀ ਮੁਸ਼ਕਲ ਨਾਲ ਉਸਦੇ ਜਨਮਦਿਨ 'ਤੇ ਉਸ ਨੂੰ ਇੱਕ ਕਾਰਡ ਬਣਾਇਆ ਉਸ 'ਤੇ ਉਸਦੇ ਬਾਰੇ ਵਿੱਚ ਲਿਖਿਆ ਅਤੇ ਉਹਨੂੰ ਸਰਪ੍ਰਾਈਜ਼ ਦੇ ਤੌਰ 'ਤੇ ਮੈਂ ਉਸਨੂੰ ਉਸਦੇ ਕੋਲ ਰੱਖ ਤ ਦੇ ਦਿੱਤਾ ਉਹਨੂੰ ਜਨਮ ਦਿਨ ਵਾਲੇ ਦਿਨ ਅਤੇ ਜਦ ਉਸਨੇ ਉਹ ਲਾਈਨਾਂ ਪੜ੍ਹੀਆਂ ਅਤੇ ਉਹਨੂੰ ਵੀ ਖੁਸ਼ੀ ਵੀ ਬਹੁਤ ਹੋਈ ਅਤੇ ਉਹ ਹੈਰਾਨੀ ਵੀ ਬਹੁਤ ਹੋਈ ਮੰਮਾ ਕਹਿੰਦੀ ਤੁਹਾਨੂੰ ਤਾਂ ਕੋਈ ਉਹ ਨਹੀਂ ਪਰ ਫੇਰ ਵੀ ਤੁਸੀਂ ਮੇਰੇ ਵਾਸਤੇ ਜੋ ਲਿਖਿਆ ਹੈ ਇਹ ਬਹੁਤ ਵਧੀਆ ਲਿਖਿਆ ਹੈ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੇਰੀ ਮੰਮੀ ਮੇਰੇ ਬਾਰੇ ਐਨਾ ਸੋਚਦੀ ਹੈ ਅਤੇ ਮੈਨੂੰ ਐਨਾ ਪਿਆਰ ਕਰਦੇ ਹੈ